ਵਿਦਿਆਰਥੀ ਨਿਯਮਤ ਤੌਰ 'ਤੇ ਸਕੂਲ ਨਹੀਂ ਜਾ ਸਕਦੇ ਉਹਨਾਂ ਵਿੱਚ ਕਈ ਕਾਰਨ ਹਨ ਜਿਵੇਂ ਕਈ ਵਾਰ ਬੱਚਿਆਂ ਦੇ ਮਾਪੇ ਗਰੀਬ ਹੁੰਦੇ ਹਨ ਉਹਨਾਂ ਕੋਲ ਕੋਈ ਆਮਦਨ ਦੇ ਸਾਧਨ ਜ਼ਿਆਦਾ ਨਹੀਂ ਹੁੰਦੇ ਅਤੇ ਬੱਚਿਆਂ ਨੂੰ ਉਹਨਾਂ ਨਾਲ ਕੰਮ ਕਰਵਾਉਣਾ ਪੈਂਦਾ ਹੈ ਅਤੇ ਸਕੂਲ ਤੋਂ ਛੁੱਟੀ ਵੀ ਕਰਨੀ ਪੈ ਜਾਂਦੀ ਹੈ ਕਈ ਵਾਰ ਪਿੰਡ ਤੋਂ ਸਕੂਲ ਦੂਰ ਹੋਣ ਕਰਕੇ ਉਹ ਸਾਈਕਲ ਵੀ ਨਹੀਂ ਲੈ ਸਕਦੇ ਅਤੇ ਸਕੂਲ ਵੈਨ ਦੀ ਫੀਸ ਨਹੀਂ ਭਰ ਸਕਦੇ ਅਤੇ ਸਕੂਲ ਬੱਚਿਆਂ ਨੂੰ ਘੱਟ ਭੇਜਦੇ ਹਨ ਕਈ ਵਾਰ ਬਾਰਿਸ਼ ਲਗਾਤਾਰ ਹੋਣ ਕਰਕੇ ਪਾਣੀ ਆਦਿ ਜ਼ਿਆਦਾ ਖੜ੍ਹਾ ਹੋ ਜਾਂਦਾ ਹੈ ਤਾਂ ਵੀ ਬੱਚੇ ਸਕੂਲ ਨਹੀਂ ਜਾ ਪਾਉਂਦੇ ਇਸ ਤਰ੍ਹਾਂ ਬਹੁਤ ਸਾਰੇ ਕਾਰਨ ਆ ਬੱਚਿਆਂ ਦੇ ਲਗਾਤਾਰ ਸਕੂਲ ਨਾ ਜਾ ਸਕਣ ਦੇ